ਪੰਜਾਬ ਵਿੱਚ ਬਹੁਤ ਲੇਖਕ ਅਤੇ ਕਵੀ ਹਨ ਪਰ ਮੈਨੂੰ ਜੋ ਸਭ ਤੋਂ ਵੱਧ ਪਸੰਦ ਹੈ ਉਹ ਕਵੀ ਕੁਲਵੰਤ ਸਿੰਘ ਵਿਰਕ ਹੈ ਉਹਨਾਂ ਦੀਆਂ ਕਹਾਣੀਆਂ ਬਹੁਤ ਰਚ ਉਹਨਾਂ ਦੀਆਂ ਰਚਨਾਵਾਂ ਬਹੁਤ ਜ਼ਿਆਦਾ ਹਨ ਅਕੱਥ ਕਥਾ ਇੱਕ ਕਿਤਾਬ ਦੇ ਵਿੱਚ ਉਹਨਾਂ ਦੀਆਂ ਕਹਾਣੀਆਂ ਹਨ ਅਤੇ ਹੋਰ ਵੀ ਕਿਤਾਬਾਂ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਬਹੁਤ ਮਸ਼ਹੂਰ ਹਨ ਉਹਨਾਂ ਦਾ ਜਨਮ ਵੀਹ ਮਈ ਉੱਨੀ ਸੌ ਇੱਕੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਜਨਮ ਅਸਥਾਨ ਜ਼ਿਲ੍ਹਾ ਸ਼ੇਖਪੁਰਾ ਪਾਕਿਸਤਾਨ ਵਿਖੇ ਹੋਇਆ ਸੀ ਉਹਨਾਂ ਦੀ ਵਿੱਦਿਆ ਜਾਂ ਐੱਮ ਏ ਅੰਗਰੇਜ਼ੀ ਵਿੱਚੋਂ ਹੋਈ ਸੀ ਅਤੇ ਉਹਨਾਂ ਨੇ ਐੱਲ ਐੱਲ ਬੀ ਵੀ ਕਰੀ ਹੋਈ ਸੀ ਉਹਨਾਂ ਵੱਲੋਂ ਉਹਨਾਂ ਨੂੰ ਇਨਾਮ ਵੀ ਬਹੁਤ ਮਿਲੇ ਹੋਏ ਸੀ ਜਿਵੇਂ ਉੱਨੀ ਸੌ ਉਣੰਜਾ ਦੇ ਵਿੱਚ ਇੱਕ ਇਨਾਮ ਮਿਲਿਆ ਸੀ ਅਤੇ ਉਨਾਂ ਦਾ ਨਵੇਂ ਲੋਕ ਲਈ ਭਾਰਤੀ ਸਾਹਿਤ ਅਕਾ ਅਕੈਡਮੀ ਅਵਾਰਡ ਉਹਨਾਂ ਨੂੰ ਮਿਲਿਆ ਸੀ ਅਤੇ ਨਵੇਂ ਲੋਕ ਕਹਾਣੀ ਸੰਗ੍ਰਹਿ ਵਿੱਚੋਂ ਉਹਨਾਂ ਦੀਆਂ ਕਹਾਣੀਆਂ ਲਈਆਂ ਗਈਆਂ ਸਨ ਉਹਨਾਂ ਦੀਆਂ ਦੋ ਕਹਾਣੀਆਂ ਕਸ਼ਟ ਨਿਵਾਰਨ ਅਤੇ ਕੋਡੀ ਬਦਲ ਜਾਏ ਮੇਰੇ ਮਨ ਨੂੰ ਲੱਗ ਗਈ ਸੀ ਉਹ ਆਪਣੀ ਕਹਾਣੀਆਂ ਦੇ ਵਿੱਚ ਸਧਾਰਨ ਮਨੁੱਖ ਬਾਰੇ ਗੱਲ ਕਰਦੇ ਹਨ ਵੀ ਜੋ ਸਮਾਜਿਕ ਜੀਵਨ ਦੇ ਦੋਸ਼ ਦੇ ਸਧਾਰਨ ਮਨੁੱਖ ਦੀ ਸ਼ਖਸੀਅਤ ਵਿੱਚ ਸੰਕਟ ਪੈਦਾ ਹੋ ਰਹੇ ਹਨ ਉਹਨਾਂ ਨੂੰ ਇਸ ਕਹਾਣੀ ਵਿੱਚ ਪੇਸ਼ ਕਰਦ ਕਹਾਣੀਆਂ ਦੇ ਵਿੱਚ ਪੇਸ਼ ਕਰਦੇ ਹਨ ਜੋ ਸਧਾਰਨ ਮਨੁੱਖ ਆਪਣੇ ਆਲੇ ਦੁਆਲੇ ਫੈਲੇ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਤੋਂ ਬਚਣ ਲਈ ਯਤਨ ਕਰਦਾ ਹੈ ਪਰ ਅੰਤ ਵਿੱਚ ਅਜਿਹੇ ਹਾਲਾਤਾਂ ਵਿੱਚ ਉਸ ਦੇ ਯਤਨ ਸਫਲ ਨਹੀਂ ਹੁੰਦੇ ਤਾਂ ਉਹਨਾਂ ਦਾ ਮਨ ਵੀ ਈਰਖਾ ਦੇ ਨਾਲ ਜਾਂ ਵੈਰ ਨਾਲ ਭਰ ਜਾਂਦਾ ਹੈ ਜਦੋਂ ਉਹ ਆਪਣੇ ਸਾਥੀਆਂ ਨੂੰ ਦੇਖਦੇ ਹਨ ਵੀ ਮੇਰੇ ਸਾਥੀ ਬਹੁਤ ਅਮੀਰ ਹਨ ਅਤੇ ਉਹ ਪੈਸਾ ਕਮਾ ਰਹੇ ਹਨ ਅਤੇ ਫਿਰ ਉਹਨਾਂ ਨੂੰ ਹੁੰਦਾ ਵੀ ਮੈਂ ਵੀ ਕੋਈ ਕੰਮ ਕਰਾਂ ਅਤੇ ਉਹਨਾਂ ਦਾ ਜੋ ਸੁਭਾਅ ਈਰਖਾ ਵਿੱਚ ਬਦਲ ਜਾਂਦਾ ਹੈ ਅਤੇ ਵੀ ਉਹ ਆਪਣੀ ਕਹਾਣੀਆਂ ਦੇ ਵਿੱਚ ਵਿਅੰਗ ਰਾਹੀਂ ਪੇਸ਼ ਕਰਦੇ ਹਨ ਸਮਾਜ ਵਿੱਚ ਕਮਜ਼ੋਰ ਲੋਕਾਂ ਦੇ ਹੱਕ ਜ਼ੋਰਾਵਰ ਲੋਕ ਆਪਣੇ ਕਸ਼ਟ ਨਿਵਾਰਨ ਲਈ ਕੀ ਲਈ ਹੀ ਵਰਤਦੇ ਹਨ